ਮੈਂ ਰੋਪੜ ਤੋਂ ਮੈਕਲੋਡਗੰਜ਼ ਜਾਣਾ ਸੀਗਾ ਜਾਣ ਵਾਸਤੇ ਗੱਡੀ ਚੱਕੀ ਰਾਸਤੇ ਵਿੱਚ ਫੂਲ ਪਿੰਡ ਤੋਂ ਆਪਣੇ ਇੱਕ ਦੋਸਤ ਅਵਤਾਰ ਨੂੰ ਬਿਠਾਇਆ ਉਸ ਤੋਂ ਅਗਲੇ ਪਿੰਡ ਸੁਰਤਾਪੁਰ ਤੋਂ ਦੂਸਰੇ ਦੋਸਤ ਜਗਤਾਰ ਨੂੰ ਬਿਠਾਇਆ ਔਰ ਉਸ ਤੋਂ ਅੱਗੇ ਜਾ ਕੇ ਘਨੋਲੀ ਪਿੰਡ ਤੋਂ ਅਜੇ ਨੂੰ ਬਿਠਾਇਆ ਔਰ ਉਸ ਤੋਂ ਅਗਲੇ ਪਿੰਡ ਤੋਂ ਆਪਣੇ ਇੱਕ ਹੋਰ ਦੋਸਤ ਨੂੰ ਬਿਠਾ ਕੇ ਅਸੀਂ ਮੈਕਲੋਡਗੰਜ਼ ਵੱਲ ਨੂੰ ਤੁਰ ਪਏ ਰਸਤੇ ਵਿੱਚ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਆਈ ਮੈਕਲੋਡਗੰਜ਼ ਪਹੁੰਚਦਿਆਂ ਪਹੁੰਚਦਿਆਂ ਸਾਰ ਅਸੀਂ ਟਰੈਕਿੰਗ ਕਰਨੀ ਸ਼ੁਰੂ ਕੀਤੀ ਸਾਡੇ ਦੋਸਤ ਦੀ ਉਮਰ ਜ਼ਿਆਦਾ ਹੋਣ ਕਰਕੇ ਉਸ ਨੂੰ ਚੜ੍ਹਨ ਵਿੱਚ ਕਾਫ਼ੀ ਦਿੱਕਤ ਆ ਰਹੀ ਸੀ ਅਸੀਂ ਉਸਦੀ ਹੈਲਪ ਕੀਤੀ ਔਰ ਉਸਨੂੰ ਚਾਹ ਪਾਣੀ ਪਿਲਾਇਆ ਉਸ ਤੋਂ ਬਾਅਦ ਅਸੀਂ ਅੱਗੇ ਨੂੰ ਤੁਰ ਪਏ ਅੱਗੇ ਜਾ ਕੇ ਅੱਗੇ ਜਾ ਕੇ ਅਸੀਂ ਮੈਕਲੋਡਗੰਜ਼ ਪਹੁੰਚ ਗਏ ਔਰ ਉੱਥੇ ਦਾ ਵਿਉ ਕਾਫ਼ੀ ਅੱਛਾ ਸੀਗਾ ਸਾਨੂੰ ਕਾਫ਼ੀ ਅਨੰਦ ਆਇਆ ਔਰ ਉਸ ਤੋਂ ਬਾਅਦ ਅਸੀਂ ਘਰਾਂ ਨੂੰ ਵਾਪਿਸ ਆ ਗਏ